ਪੰਜਾਬੀ ਭਾਸ਼ਾ ਬਾਕੀ ਭਾਸ਼ਾਵਾਂ ਤੋਂ ਸਭ ਤੋਂ ਪਿਆਰੀ ਅਤੇ ਮਿੱਠੀ ਭਾਸ਼ਾ ਹੈ ਇਹ ਸੰਸਾਰ ਦੀ ਚੌਥੀ ਭਾਸ਼ਾ ਹੈ ਇਸ ਨੂੰ ਪੰਜਾਬੀ ਰਾ ਭਾਸ਼ਾ ਰਾਜ ਦੀ ਇੱਕ ਓਫਿਸ਼ਅਲ ਭਾਸ਼ਾ ਵੀ ਮੰਨੀ ਗਈ ਹੈ ਅੱਜ ਕੱਲ੍ਹ ਸਾਰਾ ਕੰਮ ਦਫਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਹੀ ਕੀਤੇ ਜਾਂਦੇ ਜਿੰਨੇ ਵੀ ਅਸੀਂ ਫਾਰਮ ਭਰਨੇ ਹੁੰਦੇ ਹਨ ਜਾਂ ਕੋਈ ਸਰਕਾਰੀ ਕੰਮ ਹੈ ਸਭ ਪੰਜਾਬੀ ਦੇ ਵਿੱਚ ਹੀ ਕੀਤਾ ਜਾਂਦਾ ਹੈ ਇਹ ਇਕ ਮਿੱਠੀ ਅਤੇ ਸੌਖੀ ਭਾਸ਼ਾ ਹੈ ਜਿਹੜੀ ਕਿ ਸਾਡੀ ਹਰਮਨ ਪਿਆਰੀ ਭਾਸ਼ਾ ਹੈ ਪੰਜਾਬੀ ਜਿਹੜੀ ਪ ਪ ਹੈਗੀ ਹੈ ਉਹ ਸਿੱਖੀ ਦੀ ਧਾਰਮਿਕ ਭਾਸ਼ਾ ਹੈ ਸਭ ਤੋਂ ਪਹਿਲਾਂ ਗੁਰਮੁਖੀ ਭਾਸ਼ਾ ਜਿਹੜੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਅਤੇ ਪੰਜਾਬੀ ਭਾਸ਼ਾ ਵਿੱਚ ਹੀ ਤਿਆਰ ਕੀਤਾ ਗਿਆ ਸੀ ਪੰਜਾਬੀ ਭਾਸ਼ਾ ਜਿਸ ਦੇ ਨਾਲ ਅਸੀਂ ਹਰ ਇੱਕ ਨੂੰ ਆਪਣੀ ਗੱਲ ਬੜੇ ਸੌਖੇ ਤਰੀਕੇ ਨਾਲ ਸਮਝਾ ਸਕਦੇ ਹਾਂ ਅਤੇ ਅਗਲਾ ਵੀ ਸਾਡਾ ਸਮ ਜਿਹੜੀ ਸਾਡੀ ਗੱਲ ਨੂੰ ਸਮਝ ਸਕਦਾ ਹੈ ਇਹ ਇੱਕ ਮਿੱਠੀ ਅਤੇ ਵਧੀਆ ਭਾਸ਼ਾ ਹੈ ਜਿਸ ਦੇ ਨਾਲ ਕਿ ਸਾਨੂੰ ਆਪਣੇ ਮਨ ਦੇ ਭਾਵਾਂ ਨੂੰ ਦੱਸਣ ਦਾ ਸੌਖਾ ਅਤੇ ਸਸਤਾ ਤਰੀਕਾ ਮਿਲਦਾ ਹੈ